ਬੀਮਾ ਸਾਨੂੰ ਜਿਹੜਾ ਅਸੀਂ ਜਦੋਂ ਅਸੀਂ ਪਸ਼ੂ ਪਾਲਦੇ ਹਨ ਅਤੇ ਸਾਨੂੰ ਬਿਮਾਰੀਆਂ ਤੋਂ ਬਚਣਾ ਚਾਹੀਦਾ ਹੈ ਸਾਨੂੰ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਚਾਰਾ ਨਹੀਂ ਪਾਉਣਾ ਚਾਹੀਦਾ ਕਿ ਜਿਹੜਾ ਉਹਨਾਂ ਨੂੰ ਬਿਮਾਰੀਆਂ ਮਤਲਬ ਲੱਗ ਸਕਣ ਇਸ ਤਰ੍ਹਾਂ ਦੀਆਂ ਤੋਂ ਉਹਨਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਸਾਨੂੰ ਇਹਨਾਂ ਨੂੰ ਕਦੇ ਵੀ ਸਾਫ ਜਗ੍ਹਾ 'ਤੇ ਮਤਲਬ ਬੰਨ੍ਹ ਕੇ ਰੱਖਣਾ ਚਾਹੀਦਾ ਕਿ ਉਹਨਾਂ ਦਾ ਜਿਹੜਾ ਗੋਹਾ ਹੁੰਦਾ ਹੈ ਉਹ ਸਾਫ ਸੁਥਰਾ ਹੋਣਾ ਚਾਹੀਦਾ ਉਹਨਾਂ ਦੇ ਜਿਹੜੇ ਪੈਰ ਆ ਉਹ ਗਲਨੇ ਨਹੀਂ ਚਾਹੀਦੇ ਮੂੰਹ ਉਹਨਾਂ ਦਾ ਜਿਹੜਾ ਪੱਠਿਆਂ ਨੂੰ ਵਧੀਆ ਤਰੀਕੇ ਨਾਲ ਪਾਉਣਾ ਚਾਹੀਦਾ ਆ ਅਤੇ ਕੋਈ ਵੀ ਮਾੜਾ ਪੱਠਾ ਨਹੀਂ ਪਾਉਣਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਇਹਦੀ ਸੰਭਾਲ ਬੜੇ ਤਰੀਕੇ ਨਾਲ ਕੀਤੀ ਜਾਂਦੀ ਹੈ ਤਾਂ ਕਿ ਸਾਨੂੰ ਉਹਨਾਂ ਨੂੰ ਉਹਨਾਂ ਤੋਂ ਵਧੀਆ ਸਫਾਈ ਕੂੜਾ ਕਰਕਟ ਗੋਹਾ ਵਗੈਰਾ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਥੱਲੇ ਉਹਨਾਂ ਦੇ ਜਿਹੜੇ ਉਹ ਗੋਹਾ ਬਾਥਰੂਮ ਵਗੈਰਾ ਹੁੰਦਾ ਹੈ ਉਹ ਉਹਨਾਂ ਦੇ ਮਤਲਬ ਪੈਰਾਂ ਥੱਲੇ ਹੁੰਦਾ ਅਤੇ ਉਹ ਪੈਰ ਗਲ ਜਾਂਦੇ ਆ ਉਹਨਾਂ ਦੇ ਅਤੇ ਜਿਹੜਾ ਉਹਨਾਂ ਦੇ ਪੱਠੇ ਪੱਠਿਆਂ ਵਾਲਾ ਪੱਠਿਆਂ ਤੋਂ ਹੁੰਦਾ ਕਿ ਸਾਨੂੰ ਚੰਗੇ ਪੱਠੇ ਪਾਉਣੇ ਚਾਹੀਦੇ ਹੈ ਸਮੇਂ ਤੋਂ ਸਮੇਂ ਜਿਹੜਾ ਪੱਠਾ ਬੀਜਣਾ ਉਹ ਬੀਜਣੇ ਚਾਹੀਦੇ ਹੈ ਮਤਲਬ ਇਸ ਤਰ੍ਹਾਂ ਟਾਈਮ ਟੂ ਟਾਈਮ ਪੱਠੇ ਜਿਹੜਾ ਨਹੀਂ ਟਾਈਮ ਆ ਉਹ ਪੱਠਾ ਨਹੀਂ ਪਾਉਣਾ ਚਾਹੀਦਾ ਸਾਨੂੰ ਕਿ ਕੁਝ ਇੱਦਾਂ ਦੀ ਜੜੀ ਬੂਟੀਆਂ ਹੁੰਦੀਆਂ ਜਿਹੜੀਆਂ ਉਹਨਾਂ ਦੇ ਮਤਲਬ ਪੱਠਿਆਂ ਵਿੱਚ ਆ ਜਾਂਦੀਆਂ ਅਤੇ ਉਹ ਉਹਨਾਂ ਨੂੰ ਮਤਲਬ ਬਿਮਾਰੀਆਂ ਲਗਾ ਦਿੰਦੀਆਂ ਹਨ ਸਾਨੂੰ ਦੇਖ ਕੇ ਉਹਨਾਂ ਨੂੰ ਪੱਠਾ ਪਾਉਣਾ ਚਾਹੀਦਾ ਅਤੇ ਉਹਨਾਂ ਦੇ ਥੱਲੇ ਪੈਰਾਂ ਥੱਲੇ ਉਹਨਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਜੋ ਕਿ ਉਹਨਾਂ ਦੇ ਪੈਰ ਗਲ ਸੜ ਜਾਣ ਸਾਨੂੰ ਉਹਨਾਂ ਨੂੰ ਸਹੀ ਤਰੀਕੇ ਨਾਲ ਰੱਖਣਾ ਚਾਹੀਦਾ ਦੇਖਭਾਲ ਕਰਨੀ ਚਾਹੀਦੀ ਆ ਸਾਨੂੰ ਮਤਲਬ ਪਾਲਣਾ ਪਸ਼ੂਆਂ ਪਾ ਪਸ਼ੂ ਪਾਲਣ ਵਿੱਚ ਬੜਾ ਮਤਲਬ ਸੰਘਰਸ਼ ਕਰਨਾ ਪੈਂਦਾ ਹੈ ਇਸ ਇਸ ਪਸ਼ੂਆਂ ਨਾਲ ਪਸ਼ੂ ਬਣਨਾ ਪੈਂਦਾ ਹੈ ਬੜੇ ਤਰੀਕੇ ਨਾਲ ਉਹਨਾਂ ਨੂੰ ਪਾਲਣਾ ਪੋਸਣਾ ਪੈਂਦਾ ਹੈ